ਭੰਗੜੇ ਦੀ ਮਹੱਤਤਾ ਅਤੇ ਇਸ ਦੀ ਵਿਸ਼ਵ ਵਿਆਪੀ ਪ੍ਰਸਿੱਧੀ ਭੰਗੜਾ ਨਾ ਸਿਰਫ ਪੰਜਾਬ ਦਾ ਬਲਕੀ ਪੂਰੀ ਦੁਨੀਆਂ ਦੀ ਸੱਭਿਆਚਾਰਕ ਵਿਰਾਸਤ ਦਾ ਇੱਕ ਅਨਮੋਲ ਰਤਨ ਹੈ ਇਹ ਨਾਚ ਨਾ ਸਿਰਫ ਮਨੋਰੰਜਨ ਦਾ ਸਾਧਨ ਹੈ ਸਗੋਂ ਇਹ ਪੰਜਾਬੀਆਂ ਦੀਆਂ ਜੀਵਨ ਸ਼ੈਲੀ ਰੀਤੀ ਰਿਵਾਜਾਂ ਅਤੇ ਸੱਭਿਆਚਾਰ ਦੀ ਝਲਕ ਵੀ ਪੇਸ਼ ਕਰਦਾ ਹੈ ਭੰਗੜੇ ਦੀ ਮਹਤੱਤਾ ਖ਼ੁਸੀਂ ਦਾ ਪ੍ਰਗਟਾਵਾ ਭੰਗੜਾ ਖੁਸ਼ੀ ਉਤਸਾਹ ਅਤੇ ਜਸ਼ਨ ਦਾ ਪ੍ਰਤੀਕ ਹੈ ਇਹ ਖੇਤਾਂ ਵਿੱਚ ਮਿਹਨਤ ਕਰਨ ਤੋਂ ਬਾਅਦ ਮਿਲੀ ਕਾਮਯਾਬੀ ਦਾ ਜਸ਼ਨ ਮਨਾਉਣ ਦਾ ਇੱਕ ਤਰੀਕਾ ਹੈ ਸੱਭਿਆਚਾਰਕ ਪਛਾਣ ਭੰਗੜਾ ਪੰਜਾਬੀਆਂ ਦੀ ਸਭਿਆਚਾਰਕ ਪਛਾਣ ਦਾ ਇੱਕ ਅਹਿਮ ਹਿੱਸਾ ਹੈ ਇਹ ਨਾਚ ਪੰਜਾਬੀ ਦੀਆਂ ਜੀਵਨ ਸ਼ੈਲੀ ਰੀਤੀ ਰਿਵਾਜਾਂ ਅਤੇ ਸਭਿਆਚਾਰ ਨੂੰ ਦੁਨੀਆਂ ਭਰ ਵਿੱਚ ਪੇਸ਼ ਕਰਦਾ ਹੈ ਕਸਰਤ ਅਤੇ ਸਿਹਤ ਭੰਗੜਾ ਇੱਕ ਤੰਦਰੁਸਤੀ ਲਈ ਵੀ ਬਹੁਤ ਵਧੀਆ ਕਸਰਤ ਹੈ ਇਸ ਵਿੱਚ ਸਰੀਰ ਦੇ ਹਰ ਹਿੱਸੇ ਨੂੰ ਹਿਲਾਇਆ ਜਾਂਦਾ ਹੈ ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਮੋਟੇ ਤੋਂ ਮੋਟਾ ਆਦਮੀ ਵੀ ਅਗਰ ਚਾਰ ਤੋਂ ਪੰਜ ਮਹੀਨੇ ਭੰਗੜਾ ਕਰੀ ਜਾਏ ਤਾਂ ਉਹ ਵੀ ਪਤਲਾ ਹੋ ਜਾਂਦਾ ਹੈ ਏਕਤਾ ਅਤੇ ਭਾਈਚਾਰਾ ਭੰਗੜਾ ਲੋਕਾਂ ਨੂੰ ਇਕੱਠਾ ਕਰਨ ਅਤੇ ਭਾਈਚਾਰਾ ਬਣਾਉਣ ਦਾ ਇੱਕ ਵਧੀਆ ਸਾਧਨ ਹੈ ਇਹ ਨਾਚ ਲੋਕਾ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਉਹਨਾਂ ਵਿੱਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦਾ ਹੈ ਭੰਗੜਾ ਦੁਨੀਆਂ ਭਰ ਵਿੱਚ ਭੰਗੜਾ ਹੁਣ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਰਿਹਾ ਇਹ ਨਾਚ ਦੁਨੀਆਂ ਭਰ ਵਿੱਚ ਵੀ ਬਹੁਤ ਮਸ਼ਹੂਰ ਹੋ ਗਿਆ ਹੈ ਜਿਵੇਂ ਕਿ ਦਿਲਜੀਤ ਦੁਸਾਂਝ ਨੇ ਕੁਚੇਲਾ ਵਾਲੇ ਸ਼ੋਅ ਵਿੱਚ ਪੰਜਾਬੀਆਂ ਦਾ ਭੰਗੜਾ ਕਰਾਇਆ ਸੀ ਨਾਲ ਅੰਗਰੇਜ਼ਾਂ ਨੂੰ ਵੀ ਨਚਾ ਦਿੱਤਾ ਭੰਗੜਾ ਨਾ ਸਿਰਫ ਇੱਕ ਨਾਚ ਹੈ ਸਗੋਂ ਇਹ ਪੰਜਾਬੀਆਂ ਦੀ ਜੀਵਨ ਸ਼ੈਲੀ ਰੀਤੀ ਰਿਵਾਜਾਂ ਅਤੇ ਸੱਭਿਆਚਾਰ ਦਾ ਇੱਕ ਅਨਮੋਲ ਰਤਨ ਹੈ ਇਸ ਦੀ ਮਹੱਤਤਾ ਦੇਖਦੇ ਹੋਏ ਭਾਰਤ ਸਰਕਾਰ ਨੇ ਭੰਗੜੇ ਨੂੰ ਆਯੁਸ਼ਮਾਨ ਮੰਤਰਾਲੇ ਦੁਆਰਾ ਪ੍ਰਚਾਰਿਤ ਕਰਨ ਦਾ ਫੈਸਲਾ ਕੀਤਾ ਹੈ